ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਪੰਜਾਬੀ ਸਭ ਤੋਂ ਉੱਤੇ ਰੱਖੀ ਜਾ ਜਾ ਰਹੀ ਹੈ ਹਰ ਥਾਂ ਉੱਤੇ ਪੰਜਾਬੀ ਦਾ ਬੋਰਡ ਸਭ ਤੋਂ ਉੱਤੇ ਲਿਖਿਆ ਜਾਂਦਾ ਚ ਜਾ ਰਿਹਾ ਹੈ ਜਿਵੇਂ ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਮੰਦਰ ਹੋਵੇ ਚਾਹੇ ਉਹ ਕ ਕੋਈ ਵੀ ਥਾਂ ਹੋਵੇ ਪੰਜਾਬ ਪੰਜਾਬ ਵਿੱਚ ਲਿਖੀ ਹੋਈ ਹਰ ਚੀਜ਼ ਸਭ ਤੋਂ ਉੱਤੇ ਲਿਖੀ ਜਾ ਰਹੀ ਹੈ ਸਿਰਫ ਪੰਜਾਬ ਵਿੱਚ ਨਹੀਂ ਹੋਰ ਸਟੇਟਾਂ ਵਿੱਚ ਜਿਵੇਂ ਹਿਮਾਚਲ ਵਿੱਚ ਹੋਰ ਯੂਪੀ ਵਿੱਚ ਵੀ ਪੰਜਾਬੀ ਪੜ੍ਹਾਈ ਜਾ ਰਹੀ ਹਨ ਔਰ ਭਾਰਤ ਦੇਸ਼ ਤੋਂ ਬਾਹਰ ਵੀ ਕਨੇਡਾ ਵਿੱਚ ਪੰਜਾਬੀ ਨੂੰ ਸ ਦੂਜੀ ਭਾਸ਼ਾ ਦੀ ਮਹੱਤਤਾ ਦਿੱਤੀ ਗਈ ਹੈ ਜਿੱਥੇ ਪੰਜਾਬੀ ਵਸੇ ਹਾਂ ਅਤੇ ਉਹਨਾਂ ਨੂੰ ਪੰਜਾਬੀ ਬੋਲਣੀ ਅਤੇ ਪੜ੍ਹਨੀ ਲੋਕਾਂ ਨੂੰ ਸਿਖਾਈ ਜਾ ਰਹੀ ਹੈ